ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਵਾਕੰਸ਼ ਅਤੇ ਮੁਹਾਵਰੇ ਹਨ ਜਿਨ੍ਹਾਂ ਵਿੱਚੋਂ ਕੁਝ ਹਨ ਤੁਸੀਂ ਠੀਕ ਹੋ ਤੁਹਾਡਾ ਦਿਨ ਕਿਵੇਂ ਰਿਹਾ ਤੁਸੀਂ ਅੱਜ ਕੀ ਖਾਣਾ ਪਸੰਦ ਕਰੋਂਗੇ ਤੁਸੀਂ ਕਿੰਨੇ ਟਾਈਮ ਤੱਕ ਘਰ ਪਹੁੰਚ ਜਾਉਂਗੇ ਅਤੇ ਮੁਹਾਵਰੇ ਈਦ ਦਾ ਚੰਦ ਹੋਣਾ ਦੰਦ ਖੱਟੇ ਕਰਨਾ ਆਵਾ ਹੀ ਊਤਿਆ ਪਿਆ ਇੱਟ ਨਾਲ ਇੱਟ ਖੜਕਾਉਣੀ